ਹਾਂਜੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਦੱਸਣਾ ਚਾਹਵਾਂਗੀ ਕਿ ਮੇਰੇ ਕੋਲ ਜਿਹੜਾ ਸੀ ਸਭ ਤੋਂ ਪਹਿਲਾਂ ਫੋਨ ਮੇਰਾ ਸੀਗਾ ਨੋਕੀਆ ਦਾ ਬਟਨਾਂ ਵਾਲਾ ਫੋਨ ਉਹ ਫੋਨ ਮੈਨੂੰ ਬਹੁਤ ਪਸੰਦ ਸੀ ਕਿਉਂਕਿ ਜਿਸ ਟਾਈਮ 'ਤੇ ਮੈਨੂੰ ਉਹ ਫੋਨ ਮਿਲਿਆ ਸੀ ਉਦੋਂ ਬਹੁਤ ਘੱਟ ਲੋਕਾਂ ਕੋਲ ਫੋਨ ਹੁੰਦੇ ਸੀ ਅਤੇ ਜੇ ਕਿਸੇ ਕੋਲ ਹੁੰਦਾ ਸੀ ਤਾਂ ਉਹਦੇ ਲਈ ਉਹ ਆਪਣੇ ਆਪ ਵਿੱਚ ਬੜਾ ਮਾਣ ਮਹਿਸੂਸ ਕਰਦਾ ਸੀ ਕਿ ਮੇਰੇ ਕੋਲ ਜਿਹੜਾ ਵਾ ਉਹ ਫੋਨ ਹੈਗਾ ਵਾ ਅਤੇ ਵੇਖੋ ਫਿਰ ਹੁਣ ਅੱਜ ਸਮਾਂ ਬਦਲ ਗਿਆ ਉਹਨਾਂ ਦੀ ਜਗ੍ਹਾ 'ਤੇ ਬਹੁਤ ਸਾਰੇ ਜਿਹੜੇ ਆ ਉਹ ਫੋਨ ਆ ਗਏ ਆ ਕਈ ਤਰ੍ਹਾਂ ਦੀ ਉਹਨਾਂ ਵਿੱਚ ਅਡਵਾਂਸ ਟੈਕਨੋਲੋਜੀ ਜਿਹੜੀ ਆ ਉਹ ਆ ਗਈ ਆ ਜਿਸਨੇ ਜਿਹੜਾ ਵਾ ਉਨ੍ਹਾਂ ਫੋਨਾਂ ਦੀ ਜਿਹੜੀ ਆ ਵੈਲਿਊ ਘਟਾ ਤੀ ਅਤੇ ਹੁਣ ਸਮੇਂ ਦੇ ਨਾਲ ਮੇਰੇ ਕੋਲ ਵੀ ਇੱਕ ਸਮਾਰਟਫੋਨ ਜਿਹੜਾ ਵਾ ਆ ਗਿਆ ਵਾ ਇਹਦੇ ਵਿੱਚ ਉਸ ਫੋਨ ਦੇ ਮੁਕਾਬਲੇ ਵੇਖਿਆ ਜਾਵੇ ਤਾਂ ਇਹਦਾ ਕੈਮਰਾ ਵੀ ਬਹੁਤ ਵਧੀਆ ਵਾ ਦੂਸਰਾ ਜਿਹੜਾ ਇਹਦੀ ਗੱਲ ਕੀਤੀ ਜਾਵੇ ਇਹਦੇ 'ਚ ਵਟਸਅਪ ਯੂਟਿਊਬ ਇੱਦਾਂ ਦੇ ਬਹੁਤ ਸਾਰੇ ਜਿਹੜੇ ਆ ਉਹ ਐਪ ਹੈਗੇ ਆ ਅਤੇ ਹੋਰ ਵੀ ਜੇ ਸਾਨੂੰ ਕੁਛ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਵਾ ਉਹ ਇੰਸਟਾਲ ਜਿਹੜਾ ਇਸ ਫੋਨ ਵਿੱਚ ਕਰ ਲੈਂਦੇ ਇੰਟਰਨੈਟ ਦੇ ਥਰੂ ਅਤੇ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਜਿਹੜਾ ਵਾ ਅਸੀਂ ਇਹਦੇ ਥਰੂ ਜਿਹੜੀ ਆ ਉਹ ਗੱਲਬਾਤ ਜਿਹੜਾ ਕਰ ਲੈਂਦੇ ਪਰ ਇਹਦੇ ਕੰਪੈਰਟਿਵ ਜਿਹੜਾ ਸੀਗਾ ਪੁਰਾਣਾ ਫੋਨ ਜਿਹੜਾ ਬਟਨਾਂ ਵਾਲਾ ਫੋਨ ਸੀ ਇੱਕ ਤਾਂ ਉਹਦੇ 'ਚ ਫੋਟੋ ਦੀ ਇੰਨੀ ਕਲੈਰਟੀ ਵੀ ਨਹੀਂ ਹੁੰਦੀ ਸੀ ਦੂਸਰਾ ਉਹਦੇ 'ਚ ਕੀ ਹੁੰਦਾ ਸੀ ਉਹ 'ਚ ਟੈਕਸ ਮੈਸੇਜ ਕੀਤੇ ਜਾਂਦੇ ਸੀ ਅਤੇ ਮੈਸੇਜ ਬਾਉਚਰ ਬੱਚੇ ਪਵਾਉਂਦੇ ਹੁੰਦੇ ਸੀ ਜਾਂ ਅਸੀਂ ਪਵਾਉਂਦੇ ਹੁੰਦੇ ਸਾਂ ਅਤੇ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਫਰੈਂਡਸ ਨੂੰ ਜਿਹੜਾ ਵਾ ਉਹ ਟੈਕਸ ਮੈਸੇਜ ਜਿਹੜਾ ਵਾ ਉਹ ਕਰਦੇ ਹੁੰਦੇ ਸੀ ਜਿਹਦੇ ਵਿੱਚ ਵੀ ਉਹ ਵੀ ਇੱਕ ਉਸ ਸਮੇਂ ਦੇ ਜਿਹੜਾ ਸੀ ਉਹ ਬੜਾ ਅਡਵਾਂਸ ਕੰਮ ਜਿਹੜਾ ਸੀ ਉਹ ਮੰਨਿਆ ਜਾਂਦਾ ਸੀ ਠੀਕ ਹੈ ਅਤੇ ਇਹਦੇ ਕਿ ਪਰ ਜਿਹੜੇ ਸਮਾਰਟਫੋਨ ਆ ਹੁਣ ਉਹਦੇ ਵਿੱਚ ਵੇਖੋ ਉਹਦੇ 'ਚ ਸਾਨੂੰ ਗੂਗਲ ਦੀ ਜਿਹੜੀ ਸਹੂਲਤ ਮਿਲਦੀ ਹੈ ਅਤੇ ਗੂਗਲ ਦੇ ਥਰੂ ਜਿਹੜਾ ਵਾ ਆਪਾਂ ਕਿਸੇ ਵੀ ਚੀਜ਼ ਬਾਰੇ ਜਿਹੜੀ ਹੈ ਉਹਦੀ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਉਹ ਅਸੀਂ ਉਹ ਸਰਚ ਕਰਕੇ ਕਰ ਸਕਦੇ ਹਾਂ ਚਾਹੇ ਉਹ ਆਪਣੇ ਦੇਸ਼ ਦੀ ਕਰੰਸੀ ਬਾਰੇ ਹੋਵੇ ਜਾਂ ਪਾਪੂਲੇਸ਼ਨ ਬਾਰੇ ਹੋਏ ਭਾਵੇਂ ਪੂਰੇ ਵਲਡ ਦੀ ਕਿਸੇ ਵੀ ਕੰਟਰੀ ਬਾਰੇ ਕੋਈ ਵੀ ਜਾਣਕਾਰੀ ਅਸੀਂ ਲੈਣੀ ਹੈ ਅਤੇ ਉਹ ਅਸੀਂ ਉਹਦੇ ਥਰੂ ਜਿਹੜੀ ਆ ਉਹ ਪ੍ਰਾਪਤ ਕਰ ਲੈਂਦੇ ਹਾਂ ਐਜੂਕੇਸ਼ਨ ਨਾਲ ਵੀ ਸੰਬੰਧਿਤ ਸਪੋਰਟਸ ਨਾਲ ਸੰਬੰਧਿਤ ਕਿਸੇ ਵੀ ਫੀਲਡ ਬਾਰੇ ਅਗਰ ਸਾਨੂੰ ਕੋਈ ਵੀ ਚੀਜ਼ ਚਾਹੀਦੀ ਹੈ ਨਾ ਤਾਂ ਉਹ ਅਸੀਂ ਜਿਹੜੀ ਆ ਉਸ ਤੋਂ ਜਿਹੜੀ ਹੈ ਉਹ ਗ੍ਰਹਿਣ ਕਰ ਲੈਂਦੇ ਹਾਂ ਜਾਣਕਾਰੀ ਹਾਸਲ ਜਿਹੜੀ ਹੈ ਉਹ ਕਰ ਲੈਂਦੇ ਹਾਂ ਹੁਣ ਸਮਾਰਟਫੋਨ ਵਿੱਚ ਵੇਖੋ ਅੱਜ ਕੱਲ ਬੱਚੇ ਜਿਹੜਾ ਵਾ ਜਦੋਂ ਟਰੈਵਲ ਕਰਦੇ ਆ ਕੁਝ ਸੁਣਨਾ ਪਸੰਦ ਕਰਦੇ ਇਹਦੇ ਵਿੱਚ ਮਿਊਜਿਕ ਕਈ ਤਰ੍ਹਾਂ ਦੇ ਜਿਹੜੇ ਆ ਸਾਨੂੰ ਮਿਲ ਜਾਂਦੇ ਇੱਥੋਂ ਤੱਕ ਕਿ ਬੱਚੇ ਜਿਹੜੀਆਂ ਉਹ ਪਿਕਚਰਸ ਤੱਕ ਸੀਰੀਅਲ ਤੱਕ ਜਿਹੜੇ ਵਾ ਉਹ ਫੋਨ 'ਤੇ ਵੇਖ ਲੈਂਦੇ ਆ ਇਸ ਲਈ ਇਹਨਾਂ ਫੋਨਾਂ ਨੇ ਇਨਸਾਨ ਦੀ ਜ਼ਿੰਦਗੀ ਨੂੰ ਜਿਹੜਾ ਵਾ ਬਹੁਤ ਬਦਲਤਾ ਜੇ ਆਪਾਂ ਧਾਰਮਿਕ ਪਿਕ ਪੱਖ ਤੋਂ ਵੇਖਿਆ ਜਾਵੇ ਕਿ ਅੱਜ ਕੱਲ ਲੋਕ ਜਿਹੜਾ ਵਾ ਕਿਤੇ ਵੀ ਟਰੈਵਲ ਕਰਦੇ ਆਉਂਦੇ ਜਾਂਦੇ ਬੱਸਾਂ 'ਚ ਟ੍ਰੇਨਾਂ 'ਚ ਜਹਾਜ਼ਾਂ 'ਚ ਬੈਠੇ ਆਪਣੇ ਫੋਨ ਨੂੰ ਕੱਢ ਕੇ ਉਹਦੇ ਤੋਂ ਤੁਹਾਨੂੰ ਕੋਈ ਪਾਠ ਕਰਦੇ ਜਾਂ ਕੋਈ ਆਪਣਾ ਭਜਨ ਕਰਦੇ ਵੀ ਜਿਹੜਾ ਵਾ ਉਹ ਨਜ਼ਰ ਆਉਣਗੇ ਕਿਉਂਕਿ ਉਹ ਸਾਰਾ ਕੰਮ ਜਿਹੜਾ ਵਾ ਉਹ ਫੋਨ ਤੋਂ ਹੀ ਕਰ ਲੈਂਦੇ ਅਤੇ ਹੋਰ ਵੇਖੋ ਆਪਾਂ ਨੂੰ ਪਹਿਲੇ ਟਾਈਮ ਦੇ ਜਿਹੜੇ ਬੱਚਿਆਂ ਦੇ ਕੋਲ ਫੋਨ ਨਹੀਂ ਹੁੰਦੇ ਸੀ ਅਤੇ ਉਹਨਾਂ ਨੂੰ ਮੋਰਨਿੰਗ 'ਚ ਜਲਦੀ ਉੱਠਣਾ ਅਤੇ ਉਹਨਾਂ ਨੂੰ ਟਾਈਮ ਕਲੋਕ 'ਤੇ ਅਲਾਰਮ ਦੀ ਜ਼ਰੂਰਤ ਪੈਂਦੀ ਸੀ ਉਹਦੇ ਵਾਸਤੇ ਉਨ੍ਹਾਂ ਨੂੰ ਟਾਇਮ ਕਲੋਕ 'ਤੇ ਜਿਹੜਾ ਵਾ ਅਲਾਰਮ ਓਨ ਕਰਨਾ ਪੈਂਦਾ ਸੀ ਅੱਜ ਦੇ ਸਮੇਂ ਵਿੱਚ ਜਿਹੜਾ ਵਾ ਘਰ ਘਰ ਵਿੱਚ ਸਭ ਦੇ ਕੋਲ ਫੋਨ ਆ ਅਤੇ ਟਾਈਮ ਕਲੋਕ 'ਤੇ ਜਿਹੜਾ ਅਲਾਰਮ ਸੈਟ ਨਹੀਂ ਕੀਤਾ ਜਾਂਦਾ ਅਲਾਰਮ ਜਿਹੜਾ ਵਾ ਉਹ ਫੋਨ 'ਤੇ ਹੀ ਸੈੱਟ ਕਰ ਲਿਆ ਜਾਂਦਾ ਵਾ ਅਤੇ ਸਮਾਰਟਫੋਨ ਨੇ ਜਦੋਂ ਵੇਖੋ ਲਾਕਡਾਊਨ ਲੱਗਿਆ ਸੀ ਲਾਕਡਾਊਨ ਵਿੱਚ ਹਰ ਫੀਲਡ ਵਿੱਚ ਜਿਹੜਾ ਵਾ ਫੋਨ ਨੇ ਜਿਹੜਾ ਮਹੱਤਵਪੂਰਨ ਰੋਲ ਜਿਹੜਾ ਸੀ ਅਦਾ ਕੀਤਾ ਸੀ ਜਿਵੇਂ ਕਿ ਸਕੂਲ ਲੈ ਲਓ ਸਕੂਲ ਦਾ ਸਿਲੇਬਸ ਜਿਹੜਾ ਵਾ ਉਹ ਰੁਕਿਆ ਨਹੀਂ ਕਲਾਸਿਸ ਔਨਲਾਈਨ ਲੱਗਦੀਆਂ ਰਹੀਆਂ ਘਰਾਂ 'ਚ ਬੱਚਿਆਂ ਨੇ ਆਪਣਾ ਕੰਮ ਜਿਹੜਾ ਵਾ ਉਹ ਕੰਪਲੀਟ ਕੀਤਾ ਇਹ ਸਭ ਵਿੱਚ ਫੋਨ ਨੇ ਜਿਹੜੀ ਹੈ ਬਹੁਤ ਮਹੱਤਵਪੂਰਨ ਭੂਮਿਕਾ ਜਿਹੜੀ ਹੈ ਨਿਭਾਈ ਹੈ ਅਤੇ ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਅੱਜ ਦੇ ਸਮੇਂ ਦੀ ਪ੍ਰਮੁੱਖ ਲੋੜ ਜਿਹੜੀ ਆ ਉਹ ਸਮਾਰਟਫੋਨ ਜਿਹੜਾ ਵਾ ਉਹ ਹੈਗਾ ਵਾ ਅਤੇ ਇਸ ਦੀ ਮਹੱਤਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਬੇਸ਼ੱਕ ਇਹਦੇ ਬਹੁਤ ਸਾਰੇ ਨੁਕਸਾਨ ਵੀ ਹੈਗੇ ਆ ਇਹਨੇ ਜਿਹੜਾ ਵਾ ਉਹ ਕਈ ਵਾਰ ਬੱਚਿਆਂ ਨੂੰ ਉਹਨਾਂ ਦੇ ਟ੍ਰੈਕ ਤੋਂ ਡਿਸਟ੍ਰੈਕਟ ਵੀ ਕੀਤਾ ਵਾ ਠੀਕ ਹੈ ਇਹਦਾ ਕਈ ਲੋਕਾਂ ਨੇ ਗਲਤ ਅਤੇ ਨਜਾਇਜ਼ ਫਾਇਦਾ ਵੀ ਉਠਾਇਆ ਪਰ ਇਹ ਸਭ ਕੁਝ ਨੂੰ ਵੇਖਦੇ ਹੋਏ ਵੀ ਜੇਕਰ ਅਸੀਂ ਕਿਸੇ ਸਿੱਟੇ 'ਤੇ ਪਹੁੰਚਦੇ ਹਾਂ ਤਾਂ ਇਹ ਕਿ ਸਮਾਰਟਫੋਨ ਅੱਜ ਦੇ ਸਮੇਂ ਦੀ ਮਹੱਤਵਪੂਰਨ ਜ਼ਰੂਰਤ ਬਣ ਚੁੱਕਿਆ ਅਤੇ ਹਰ ਖੇਤਰ ਵਿੱਚ ਇਹਦੀ ਇੱਕ ਮਹੱਤਵਪੂਰਨ ਭੂਮਿਕਾ ਵਾ ਇਸਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਧੰਨਵਾਦ